ਹੱਥ ਦੇ ਬਣੇ ਕੱਪੜੇ ਅਤੇ ਬਜ਼ਾਰੀ ਰੈਡੀਮੇਟ ਕੱਪੜਿਆਂ ਵਿੱਚ ਬਹੁਤ ਫਰਕ ਹੁੰਦਾ ਹੈ ਭਾਵੇਂ ਰੈਡੀਮੇਟ ਕੱਪੜਿਆਂ ਦੀ ਬਹੁਤ ਜ਼ਿਆਦਾ ਮਾਰਕਿਟ ਭਰੀ ਪਈ ਹੈ ਫਿਰ ਉਹ ਸਸਤੇ ਵੀ ਬਹੁਤ ਹੁੰਦੇ ਹਨ ਉਹ ਬਹੁਤ ਸੁੰਦਰ ਸੁੰਦਰ ਡਿਜ਼ਾਈਨ ਸੂਟ ਕੋਟ ਪੈਂਟ ਫਰਾਕ ਗਾਊਨ ਪੈਂਟ ਸ਼ਰਟ ਵਗੈਰਾ ਮਿਲਦੇ ਹਨ ਬਹੁਤ ਪਿਆਰੀ ਕਢਾਈ ਬਹੁਤ ਪਿਆਰੀਆਂ ਲੈਸਾਂ ਲੱਗੀਆਂ ਹੁੰਦੀਆਂ ਹਨ ਰੰਗਾਂ ਦਾ ਕੌਂਬੀਨੇਸ਼ਨ ਵੀ ਬਹੁਤ ਵਧੀਆ ਬਣਾਇਆ ਹੁੰਦਾ ਹੈ ਕਿਉਂਕਿ ਇਹ ਸਭ ਕੰਮ ਵਿੱਚ ਇੰਜੀਨੀਅਰ ਦੀ ਬਹੁਤ ਮਿਹਨਤ ਲੱਗੀ ਹੁੰਦੀ ਹੈ ਇੱਕ ਨਜ਼ਰ ਵਿੱਚ ਹੀ ਮੈਨੂੰ ਚੀਜ਼ ਪਸੰਦ ਆ ਜਾਂਦੀ ਹੈ ਫਿਰ ਸਾਈਜ਼ ਵੀ ਬਹੁਤ ਕਮਾਲ ਦੇ ਫਿੱਟ ਆਉਂਦੇ ਹਨ ਅਸੀਂ ਟਰਾਈ ਕਰਕੇ ਹੀ ਕੱਪੜੇ ਲੈਂਦੇ ਹਾਂ ਪਰ ਕਦੀ ਕਦੀ ਸਾਈਜ਼ ਦੀ ਮੁਸ਼ਕਲ ਆਉਂਦੀ ਹੈ ਇੱਕ ਸਾਈਜ਼ ਛੋਟਾ ਅਤੇ ਉਹ ਬਹੁਤ ਟਾਈਟ ਹੁੰਦਾ ਹੈ ਇੱਕ ਸਾਈਜ਼ ਵੱਡਾ ਲਉ ਅਤੇ ਉਹ ਬਹੁਤ ਖੁੱਲ੍ਹਾ ਹੁੰਦਾ ਹੈ ਝੋਲੇ ਵਾਂਗ ਫਿਰ ਬਹੁਤ ਪਰੇਸ਼ਾਨੀ ਹੁੰਦੀ ਹੈ ਨਾ ਲੈ ਸਕਦੇ ਹਾਂ ਨਾ ਛੱਡ ਸਕਦੇ ਹਾਂ ਕਿਉਂਕਿ ਰੰਗ ਬਹੁਤ ਪਸੰਦ ਹੁੰਦਾ ਹੈ ਡਿਜ਼ਾਈਨ ਵੀ ਬਹੁਤ ਪਸੰਦ ਹੁੰਦਾ ਹੈ ਸਸਤੇ ਵੀ ਹੁੰਦੇ ਹਨ ਸਾਈਜ਼ ਦੀ ਮੁਸ਼ਕਲ ਆ ਜਾਂਦੀ ਹੈ ਮਨ ਮਾਰ ਕੇ ਪਸੰਦ ਕਰਕੇ ਵੀ ਸਾਨੂੰ ਡਰੈੱਸ ਛੱਡਣੀ ਪੈਂਦੀ ਹੈ ਇਸ ਲਈ ਫਿਰ ਅਸੀਂ ਦੂਜਾ ਵਿਕਲਪ ਲੱਭਦੇ ਹਾਂ ਕੱਪੜਾ ਮਨਪਸੰਦ ਖਰੀਦ ਕੇ ਉਸ ਉੱਤੇ ਕਢਾਈ ਲੈਸਾਂ ਲਗਾਉਂਦੇ ਹਾਂ ਫਿਰ ਡਿਜ਼ਾਈਨ ਲੱਭਦੇ ਹਾਂ ਫਿਰ ਬੂਟੀਕ 'ਤੇ ਜਾ ਕੇ ਆਪਣੀ ਫਿਟਿੰਗ ਦੇ ਕੱਪੜੇ ਬਣਾਉਂਦੇ ਹਾਂ ਕਈ ਵਾਰੀ ਬੁਟੀਕ ਵਾਲੇ ਵੀ ਫਿਟਿੰਗ ਖਰਾਬ ਕਰ ਦਿੰਦੇ ਹਨ ਫਿਰ ਤਾਂ ਮੂਡ ਖਰਾਬ ਹੀ ਹੋ ਜਾਂਦਾ ਹੈ ਇੰਨੇ ਪੈਸੇ ਲਗਾਏ ਹੁੰਦੇ ਹਨ ਸਿਰ ਖਪਾਈ ਕੀਤੀ ਹੁੰਦੀ ਹੈ ਫਿਰ ਵੀ ਸਾਡੇ ਕੱਪੜੇ ਖਰਾਬ ਕਰ ਦਿੰਦੇ ਹਨ ਉਧੇੜ ਬੁਣ ਵਿੱਚ ਕੱਪੜਾ ਖਿੱਚ ਧੂਹ ਕਰਕੇ ਖਰਾਬ ਹੋ ਜਾਂਦਾ ਹੈ ਫਿਰ ਮਜ਼ਬੂਰੀ ਵਿੱਚ ਖੁਦ ਸੂਟ ਰੈਡੀਮੇਟ ਲੈਂਦੇ ਹਾਂ ਕੁਝ ਬੁਟੀਕ ਤੋਂ ਸਵਾ ਲੈਂਦੇ ਹਾਂ ਪਰ ਕਦੀ ਕਦੀ ਫਿਟਿੰਗ ਗੁਜ਼ਾਰੇ ਲਾਇਕ ਠੀਕ ਹੀ ਹੋ ਜਾਂਦੀ ਹੈ ਪਰ ਜੇ ਤੁਲਨਾ ਕੀਤੀ ਜਾਵੇ ਤਾਂ ਰੈਡੀਮੇਟ ਕੱਪੜੇ ਹੀ ਪਸੰਦ ਕਰਦੀ ਹਾਂ ਉਸ ਵਿੱਚ ਸਿਰ ਖਪਾਈ ਘੱਟ ਹੈ ਸਸਤੇ ਸੱਤਰ ਅੱਸੀ ਪਰਸੈਂਟ ਲੈੱਸ 'ਤੇ ਸੇਲ ਵਿੱਚੋਂ ਮਿਲ ਜਾਂਦੇ ਹਨ ਮੈਂ ਤਾਂ ਬਹੁਤ ਹਰ ਸਾਲ ਸਸਤੇ ਸੇਲ ਵਿੱਚੋਂ ਸਟੋਕ ਇਕੱਠਾ ਕਰਕੇ ਲੈ ਲੈਂਦੀ ਹਾਂ ਫਿਰ ਅਗਲੇ ਸਾਲ ਫੰਕਸ਼ਨ 'ਤੇ ਕੱਢ ਕੇ ਪਾਂਉਦੀ ਹਾਂ ਪਰ ਮੇਰਾ ਸਾਰੀਆਂ ਸਹੇਲੀਆਂ ਖੁਦ ਹੀ ਮੈਨੂੰ ਡਿਜ਼ਾਈਨ ਮਨਪਸੰਦ ਦੇ ਡਿਜ਼ਾਈਨ ਕਢਾਈ ਲੈਸਾਂ ਮੋਤੀ ਨਗ ਲਗਾ ਕੇ ਬਹੁਤ ਹੀ ਸੁੰਦਰ ਡਰੈੱਸ ਬਣਾਉਂਦੀਆਂ ਹਨ ਵਾਕਈ ਉਹ ਇੱਕ ਬਹੁਤ ਹੀ ਕੀਮਤੀ ਅਤੇ ਅਲੱਗ ਡਰੈੱਸ ਲੱਗਦੀ ਹੈ ਰੇਡੀਮੇਟ ਕੱਪੜਿਆਂ ਨੂੰ ਦਰਜੀ ਤੋਂ ਛੋਟਾ ਵੀ ਕਰਵਾਉਣਾ ਪੈਂਦਾ ਹੈ ਜਿਸ ਕਾਰਨ ਕੁਝ ਡਿਜ਼ਾਈਨ ਦਾ ਹਿੱਸਾ ਕੱਟਿਆ ਵੀ ਜਾਂਦਾ ਹੈ ਪਰ ਫਿਰ ਵੀ ਮੈਂ ਰੈਡੀਮੇਟ ਕੱਪੜੇ ਪਸੰਦ ਕਰਦੀ ਹਾਂ ਨਿਊਬੋਰਨ ਬੇਬੀ ਤੋਂ ਲੈ ਕੇ ਆਦਮੀਆਂ ਦੇ ਪੈਂਟ ਸ਼ਰਟ ਕੋਟ ਤੱਕ ਸਭ ਰੈਡੀਮੇਟ ਡਿਜ਼ਾਇਨਰ ਕੱਪੜੇ ਮਿਲ ਜਾਂਦੇ ਹਨ ਹੀਰੋਇਨਾਂ ਹੀਰੋ ਹੀਰੋਇਨਾਂ ਅਤੇ ਉਹਨਾਂ ਦੇ ਬੱਚਿਆਂ ਵਰਗੇ ਪਿਆਰੇ ਪਿਆਰੇ ਕੱਪੜੇ ਸਸਤੇ ਮਿਲ ਜਾਂਦੇ ਹਨ ਬੱਸ ਸਿਲਾਈ ਕੱਚੀ ਹੁੰਦੀ ਹੈ ਦੁਬਾਰਾ ਕਰਨੀ ਪੈਂਦੀ ਹੈ ਦੂਜੇ ਪਾਸੇ ਦਰਜੀਆਂ ਕੋਲੋਂ ਸਵਾਏ ਕੱਪੜੇ ਸਿਲਾਈ ਪੱਕੀ ਹੁੰਦੀ ਹੈ ਟਿਕਾਊ ਹੁੰਦੀ ਹੈ ਪਰ ਸਾਦੇ ਅਤੇ ਸਿੰਪਲ ਹੁੰਦੇ ਹਨ ਮੈਨੂੰ ਤਾਂ ਰੈਡੀਮੇਟ ਕੱਪੜੇ ਹੀ ਪਸੰਦ ਹਨ